ਰੀਲ ਅਤੇ ਫੋਟੋ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਰੀਲ ਵਿੱਚ ਸਾਰਾ ਦ੍ਰਿਸ਼ ਦਿਖਾਈ ਦਿੰਦਾ ਹੈ ਪਰ ਫੋਟੋ ਵਿੱਚ ਸਿਰਫ ਇੱਕ ਪਾਸਾ ਹੀ ਦਿਖਾਈ ਦਿੰਦਾ ਹੈ ਜਿਵੇਂ ਕਿ ਤੁਸੀਂ ਦੇਖ ਲਓ ਮੌਸਮ ਦਾ ਮੌਸਮ ਦਾ ਮਿਜ਼ਾਜ ਜਦੋਂ ਬਦਲਦਾ ਹੈ ਕਿ ਉਸ ਨੂੰ ਰੀਲ ਰਾਹੀਂ ਸ਼ੂਟ ਕੀਤਾ ਜਾਵੇ ਤਾਂ ਉਸ ਵਿੱਚ ਪੰਛੀਆਂ ਦੀ ਖੁਸ਼ੀ ਜ਼ਾਹਰ ਕੀਤੀ ਜਾਂਦੀ ਹੈ ਜਿਵੇਂ ਬੱਦਲ ਭੱਜਦੇ ਹਨ ਹਵਾ ਹਵਾਵਾਂ ਚੱਲਦੀਆਂ ਹਨ ਉਹ ਰੀਲ ਵਿੱਚ ਬਹੁਤ ਵਧੀਆ ਤਰੀਕੇ ਨਾਲ ਸ਼ੂਟ ਹੋ ਜਾਂਦਾ ਹੈ ਪਰ ਜੇਕਰ ਅਸੀਂ ਉਸਦੀ ਫੋਟੋ ਖਿੱਚਾਂਗੇ ਤਾਂ ਉਸ ਵਿੱਚ ਸਿਰਫ ਪੰਛੀ ਬੱਦਲ ਹੀ ਦਿਖਾਈ ਦੇਣਗੇ ਉਹਨਾਂ ਦਾ ਪ੍ਰਗਟਾਵਾ ਖੁਸ਼ੀ ਪੰਛੀਆਂ ਦੀ ਖੁਸ਼ੀ ਪੰਛੀ ਕਿਵੇਂ ਖੁਸ਼ੀ ਜ਼ਾਹਰ ਕਰ ਰਹੇ ਹਨ ਉਸ ਦਾ ਫੋਟੋ ਵਿੱਚ ਕੁਝ ਪਤਾ ਨਹੀਂ ਚੱਲਦਾ ਇਸ ਤਰ੍ਹਾਂ ਜਿਵੇਂ ਬੱਚਾ ਖੇਡ ਰਿਹਾ ਹੈ ਉਸਦੀ ਅਸੀਂ ਫੋਟੋ ਖਿੱਚਾਂਗੇ ਤਾਂ ਸਿਰਫ ਉਸਦੀ ਫੋਟੋ ਹੀ ਦਿਖਾਈ ਦੇਵੇਗੀ ਜੇਕਰ ਉਸ ਨੂੰ ਉਸ ਦੀ ਅਸੀਂ ਰੀਲ ਸ਼ੂਟ ਕਰਾਂਗੇ ਤਾਂ ਉਹ ਆਪਣੀ ਖੁਸ਼ੀ ਕਿਵੇਂ ਜ਼ਾਹਰ ਕਰ ਰਿਹਾ ਹੈ ਉਹ ਕਿਵੇਂ ਖੇਡ ਰਿਹਾ ਹੈ ਉਹ ਕੀ ਕਰ ਰਿਹਾ ਹੈ ਇਸ ਬਾਰੇ ਰੀਲ ਵਿੱਚ ਸ਼ਾਮਿਲ ਹੋ ਜਾਂਦਾ ਹੈ ਫੋਟੋ ਵਿੱਚ ਤਾਂ ਸਿਰਫ ਫੋਟੋ ਹੀ ਦਿਖਾਈ ਦਿੰਦੀ ਹੈ ਇਸ ਤਰ੍ਹਾਂ ਜਿਵੇਂ ਅਸੀਂ ਕਿਸੇ ਕਿਵੇਂ ਜਿਵੇਂ ਅਸੀਂ ਸੂਟ ਸੀ ਰਹੇ ਹਾਂ ਸੂਟ ਸੀ ਕੇ ਅਸੀਂ ਫੋਟੋ ਕਲਿਕ ਕਰਾਂਗੇ ਤਾਂ ਸਾਨੂੰ ਸਿਰਫ ਫੋਟੋ ਹੀ ਦਿਖਾਈ ਦੇਵੇਗੀ ਜੇਕਰ ਅਸੀਂ ਉਸਦੀ ਰੀਲ ਸ਼ੂਟ ਕਰਾਂਗੇ ਉਸ ਵਿੱਚ ਸਾਨੂੰ ਪਤਾ ਲੱਗੇਗਾ ਅਸੀਂ ਇਸ ਸ਼ੂਟ ਨੂੰ ਕਿਸ ਤਰ੍ਹਾਂ ਸੀਤਾ ਹੈ ਕਿਸ ਤਰ੍ਹਾਂ ਕੱਟਣਾ ਹੈ ਕਿਸ ਤਰ੍ਹਾਂ ਸੀਤਾ ਹੈ ਕਿਸ ਤਰ੍ਹਾਂ ਸੀਣ ਲਾਈ ਹੈ ਕਿਸ ਤਰ੍ਹਾਂ ਲਾਉਣੀ ਹੈ ਇਸ ਕਰਕੇ ਰੀਲ ਅਤੇ ਫੋਟੋ ਵਿੱਚ ਬਹੁਤ ਜ਼ਿਆਦਾ ਫਰਕ ਹੈ ਰੀਲ ਵਿੱਚ ਸਾਰਾ ਦ੍ਰਿਸ਼ ਦਿਖਾਈ ਦਿੰਦਾ ਹੈ ਪਰ ਫੋਟੋ ਵਿੱਚ ਸਿਰਫ ਇੱਕ ਪਾਸਾ ਹੀ ਦਿਖਾਈ ਦਿੰਦਾ ਹੈ